ਸਟੈਂਪ ਅਤੇ ਸਿੱਕਿਆਂ ਨੂੰ ਇਕੱਠਾ ਕਰਨ ਦੇ ਵੈਸੇ ਤਾਂ ਦੋ ਉਦੇਸ਼ ਹੁੰਦੇ ਆ ਕੁਝ ਲੋਕ ਇਹਨੂੰ ਸ਼ੌਂਕੀਆ ਤੌਰ 'ਤੇ ਇਕੱਠਾ ਕਰਦੇ ਹਾਂ ਬਟ ਜੇ ਆ ਅਸੀਂ ਇਹ ਤੋਂ ਕੁਝ ਸਿੱਖਣ ਦੀ ਗੱਲ ਕਰੀਏ ਤਾਂ ਸਟੈਂਪ ਅਤੇ ਸਿੱਕਿਆਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ ਜਿਵੇਂ ਕਿ ਸਾਨੂੰ ਕਿਸੇ ਵੀ ਕੰਟਰੀ ਦੇ ਜਦੋਂ ਸਾਡੇ ਕੋਲੇ ਸਟੈਂਪਸ ਹੁੰਦੇ ਆ ਜਾਂ ਸਿੱਕੇ ਹੁੰਦੇ ਸਾਨੂੰ ਉਹਨਾਂ ਦੇ ਬਾਰੇ 'ਚ ਉਹਨਾਂ ਦੇ ਕਲਚਰ ਦੇ ਬਾਰੇ ਦੇ ਵਿੱਚ ਉਹਨਾਂ ਦੇ ਪਲੀਟੀਕਲ ਪਹਿਲਾਂ ਕਿੱਦਾਂ ਦੇ ਉਹ ਰਹੇ ਆ ਉਹ ਸਾਰਾ ਕੁਝ ਸਾਨੂੰ ਪਤਾ ਚਲਦਾ ਹੈ ਇਹਦੇ ਵਿੱਚ ਸਾਨੂੰ ਇਹ ਪਤਾ ਚਲਦਾ ਹੈ ਕਿ ਕਿਸ ਬੰਦੇ ਦੀ ਫੋਟੋ ਸਟੈਂਪ 'ਤੇ ਹੈ ਜਾਂ ਸਿੱਕਿਆਂ 'ਤੇ ਹੈ ਅਤੇ ਉਹਦਾ ਉਹਨਾਂ ਨੂੰ ਉਹ ਫੋਟੋਜ਼ ਸਿੱਕਿਆਂ ਜਾਂ ਸਟੈਂਪ 'ਤੇ ਲਾਉਣ ਦਾ ਮੁੱਖ ਉਦੇਸ਼ ਕੀ ਸੀ ਉਹਨਾਂ ਬੰਦਿਆਂ ਨੇ ਉਹਨਾਂ ਉਸ ਕੰਟਰੀਸ ਦੇ ਲਈ ਕੀ ਕੀਤਾ ਜਿਹਦੇ ਕਰਕੇ ਉਹਨਾਂ ਦੇ ਜਿਹੜੀਆਂ ਫੋਟੋਜ ਆ ਜਾਂ ਉਹਨਾਂ ਦੇ ਚਿੱਤਰ ਆ ਜਿਹੜੇ ਉਹ ਸਟੈਂਪ ਅਤੇ ਸਿੱਕਿਆਂ ਦੇ ਉੱਤੇ ਲਗਾਏ ਗਏ ਤਾਂ ਇਸ ਕਰਕੇ ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੁੰਦੇ ਆ ਇਹ ਤੋਂ ਸਾਨੂੰ ਅਲੱਗ ਅਲੱਗ ਦੇਸ਼ਾਂ ਦੀ ਸੱਭਿਅਤਾ ਬਾਰੇ ਪਤਾ ਚੱਲਦਾ ਆ ਉੱਥੋਂ ਦੇ ਬਹੁਤ ਮਸ਼ਹੂਰ ਲੋਕਾਂ ਬਾਰੇ ਪਤਾ ਚੱਲਦਾ ਜਿਨ੍ਹਾਂ ਨੇ ਉਸ ਕੰਟਰੀ ਦੇ ਡਿਵੈਲਪਮੈਂਟ ਦੇ ਵਿੱਚ ਹਿੱਸਾ ਪਾਇਆ ਅਤੇ ਕਿਉਂ ਪਾਇਆ ਜਾਂ ਕੀ ਕੀਤਾ ਉਹਨਾਂ ਨੇ ਉਹਦੇ ਬਾਰੇ ਸਾਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ